ਜੇਕਰ ਅਸੀਂ ਗੱਲ ਕਰੀਏ ਬੈਂਕਿੰਗ ਅਤੇ ਬੀਮਾ ਦੀ ਬੀਮਾ ਨਾਲ ਤਾਂ ਸਾਡਾ ਕੰਮ ਬੜਾ ਹੀ ਸੌਖਾ ਹੋ ਗਿਆ ਹੈ ਬੀਮਾ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਕਿ ਸਿਹਤ ਬੀਮਾ ਜਾਇਦਾਦ ਬੀਮਾ ਕਾਰ ਬੀਮਾ ਜੀਵਨ ਬੀਮਾ ਅਧਿਕਾਰ ਬੀਮਾ ਵਪਾਰ ਬੀਮਾ ਅਤੇ ਆਦਿ ਹੋਰ ਵੀ ਕਈ ਤਰ੍ਹਾਂ ਦੇ ਬੀਮਾ ਹੁੰਦੇ ਹਨ ਬੀਮਾ ਦੇ ਆਉਣ ਨਾਲ ਤਾਂ ਲੋਕਾਂ ਦੇ ਕਰਜ਼ੇ ਅਤੇ ਕ੍ਰੈਡਿਟ ਵੀ ਸੰਭਾਲੇ ਗਏ ਹਨ ਲੋਕ ਅੱਜ ਕੱਲ੍ਹ ਮਹਿੰਗੇ ਮਹਿੰਗੇ ਰੇਟ 'ਤੇ ਕਰੈਡਿਟ ਕਰਜ਼ੇ ਨਹੀਂ ਚੁੱਕਦੇ ਜਿਹਨਾਂ ਨੇ ਬੀਮਾ ਕਰਵਾਇਆ ਹੋਵੇ ਉਹਨਾਂ ਨੂੰ ਤਾਂ ਕਰਜ਼ਿਆਂ ਦੀ ਲੋੜ ਹੀ ਨਹੀਂ ਹੈ ਅੱਜ ਕੱਲ੍ਹ ਬੀਮਾ ਨੇ ਬੜਾ ਹੀ ਕੰਮ ਸੌਖਾ ਕਰ ਦਿੱਤਾ ਹੈ ਜਿਵੇਂ ਕਿ ਬੀਮਾ ਸਾਨੂੰ ਕਰਜ਼ੇ ਨਾਲੋਂ ਘੱਟ ਰੇਟ 'ਤੇ ਮਿਲਦਾ ਹੈ ਜਿਵੇਂ ਕਿਸੇ ਨੇ ਜੇ ਕਾਰ ਬੀਮਾ ਕਰਵਾਇਆ ਹੈ ਤਾਂ ਕਾਰ ਦਾ ਐਕਸੀਡੈਂਟ ਹੋਣ ਤੋਂ ਬਾਅਦ ਕਾਰ ਦੀ ਚੋਰੀ ਹੋਣ ਤੋਂ ਬਾਅਦ ਲੋਕਾਂ ਨੂੰ ਕਿਸੇ ਤੋਂ ਕਰਜ਼ਾ ਚੁੱਕਣ ਦੀ ਲੋੜ ਨਹੀਂ ਹੈ ਕਾਰ ਬੀਮਾ ਕੰਪਨੀ ਵਾਲੇ ਸਾਨੂੰ ਆਪ ਹੀ ਕਾਰ ਨੂੰ ਸਹੀ ਕਰਵਾ ਕੇ ਦਊਗੇ ਜਿਵੇਂ ਕੋਈ ਐਕਸੀਡੈਂਟ ਹੋਇਆ ਤਾਂ ਕਾਰ ਦੀ ਮੁਰੰਮਤ ਕਰਵਾ ਕੇ ਦਊਗੇ ਜੇ ਚੋਰੀ ਹੋਈ ਹੈ ਤਾਂ ਉਹਦਾ ਉਹਦਾ ਵੀ ਕੁਛ ਨਾ ਕੁਛ ਹੱਲ ਕੱਢ ਕੇ ਜ਼ਰੂਰ ਦਓਗੇ ਜੇ ਅਸੀਂ ਗੱਲ ਕਰੀਏ ਜੀਵਨ ਬੀਮਾ ਦੀ ਜੀਵਨ ਬੀਮਾ ਉਹ ਵੀ ਬੜੇ ਤਰ੍ਹਾਂ ਦੇ ਹੁੰਦੇ ਹਨ ਜੇ ਲੋਕ ਕੋਈ ਬਿਮਾਰ ਨੇ ਹਸਪਤਾਲ ਵਿੱਚ ਨੇ ਹਸਪਤਾਲ ਦਾ ਸਾਰਾ ਖਰਚਾ ਆਹੀ ਬੀਮਾ ਕੰਪਨੀ ਵਾਲੇ ਹੀ ਚੁੱਕਦੇ ਹਨ ਬੀਮਾ ਨਾਲ ਤਾਂ ਲੋਕਾਂ ਦਾ ਕੰਮ ਬੜਾ ਹੀ ਸੌਖਾ ਹੋ ਗਿਆ ਹੈ ਲੋਕਾਂ ਨੂੰ ਬੜਾ ਫਾਇਦਾ ਹੋਇਆ ਬੀਮਾ ਨਾਲ